ਹਾਂਜੀ ਭੰਗੜਾ ਅਤੇ ਐਰੋਬਿਕਸ ਡਾਂਸ ਦੇ ਰੂਪਾਂ ਤੋਂ ਵੱਖਰਾ ਹੈ ਭੰਗੜਾ ਅਤੇ ਐਰੋ ਭੰਗੜਾ ਐਰੋਬਿਕਸ ਇਹਦੇ ਨਾਲ ਮਤਲਬ ਬਾਕੀ ਡਾਂਸ ਜੋ ਵੀ ਡਾਂਸ ਜੋ ਵੀ ਦਿਨ ਚਰਿਆ ਦੇ ਵਿੱਚ ਡਾਂਸ ਵਰਤਿਆ ਜਾਂਦਾ ਹੈ ਉਹਨਾਂ ਰੂਪਾਂ ਤੋਂ ਵੱਖਰਾ ਭੰਗੜਾ ਐਰੋਬਿਕਸ ਦੇ ਨਾਲ ਅਸੀਂ ਇੱਕ ਤਾਂ ਬਹੁਤ ਹੀ ਮਜ਼ੇ ਨਾਲ ਭੰਗੜਾ ਐਰੋਬਿਕਸ ਨੂੰ ਕਰਕੇ ਆਪਣੀ ਫਿਟਨੈਸ ਨੂੰ ਵਧਾ ਸਕਦੇ ਹਾਂ ਬਹੁਤ ਅਸੀਂ ਇੰਜੋਏ ਕਰਦੇ ਹਾਂ ਕਰਦੇ ਹਾਂ ਭੰਗੜਾ ਐਰੋਬਿਕਸ ਦੇ ਨਾਲ ਅਤੇ ਸਾਡੀ ਸਿਹਤ ਨੂੰ ਵੀ ਬਹੁਤ ਫਰਕ ਪੈਂਦਾ ਇਸ ਨਾਲ